ਹੈਲੋ ਮੈਂ ਸਿਮਰਨ ਬੋਲਦੀ ਹਾਂ ਮੈਂ ਕੁਝ ਕੁ ਨਾ ਪਾਰਟੀ ਲਈ ਆਰਡਰ ਕੀਤਾ ਸੀਗਾ ਸਮਾਨ ਅਤੇ ਉਹ ਤੁਸੀਂ ਦੇ ਕੇ ਗਏ ਸੀਗੇ ਅਤੇ ਉਹ ਬਹੁਤ ਵਧੀਆ ਸੀਗਾ ਵੀਹ ਕੁ ਪੈਟੀਆਂ ਸੀ ਵੀਹ ਪੀਜ਼ੇ ਸੀ ਅਤੇ ਦਸ ਕੁ ਕੋਲਡਰਿੰਕਾਂ ਸੀ ਅਤੇ ਜਿਹੜੇ ਔਡਰ ਦੇਣ ਆਏ ਸੀਗੇ ਵੀਰਾ ਉਹ ਵੀ ਬਹੁਤ ਵਧੀਆ ਸੀ ਅਤੇ ਜਦੋਂ ਅਸੀਂ ਪ੍ਰੋਡਕਟ ਅਸੀਂ ਚੈੱਕ ਕੀਤੇ ਮਤਲਬ ਖਾਣ ਪੀਣ ਵਾਲੇ ਵਸਤੂਆਂ ਚੈੱਕ ਕੀਤੀਆ ਉਹ ਵੀ ਵਧੀਆ ਸੀਗੀਆਂ ਵਧੀਆ ਢੰਗ ਨਾਲ ਸੀ ਮਤਲਬ ਵੀ ਉਹਨਾਂ ਦਾ ਸੁਆਦ ਵੀ ਵਧੀਆ ਸੀਗਾ ਅਤੇ ਮਤਲਬ ਫਰੈਸ਼ ਸੀਗੇ ਮਤਲਬ ਬਾਸੀ ਵਗੈਰਾ ਨਹੀਂ ਸੀਗੇ ਪ੍ਰੋਡਕਟ ਚੰਗੇ ਢੰਗ ਨਾਲ ਆਏ ਅਤੇ ਹੋਰ